ਪੰਜਾਬੀ ਭਾਸ਼ਾ ਹੋਰ ਭਾਸ਼ਾਵਾਂ ਨੂੰ ਵਿਕਾਸ ਨੂੰ ਪ੍ਰਭਾਵਿਤ ਕਰਦੀ ਹੈ ਕਿਉੰਕਿ ਪੰਜਾਬੀ ਵਰਲਡ ਵਿੱਚ ਸੁਣੀ ਅਤੇ ਬੋਲੀ ਜਾਂਦੀ ਹੈ ਪੰਜਾਬ ਦੀ ਇੱਕ ਅਲੱਗ ਪਹਿਚਾਣ ਹੈ ਸਿੱਧੂ ਮੂਸੇਵਾਲੇ ਨੇ ਪੰਜਾਬ 'ਚ ਪੰਜਾਬੀ 'ਚ ਬਹੁਤ ਜ਼ਿਆਦਾ ਗਾਣੇ ਗਾਏ ਹਨ ਪੰਜਾਬੀ ਦੇ ਸਾਰੇ ਗੀਤ ਪੂਰੇ ਵਰਲਡ ਵਿੱਚ ਸੁਣੇ ਜਾਂਦੇ ਹਨ ਪੰਜਾਬੀ ਬਹੁਤ ਵਧੀਆ ਚੰਗੀ ਭਾਸ਼ਾ ਹੈ